ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਕਿਸਾਨਾਂ ਦੇ ਲਈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਉਥੋਂ ਤੋਂ ਬੀਜ ਮੁਹੱਈਆ ਕਰਾਵਾਂਗੀ ਉੱਥੇ ਦੇ ਅਧਿਆਪਕਾਂ ਤੋਂ ਉਹਨਾਂ ਨੂੰ ਟ੍ਰੇਨਿੰਗ ਦਵਾਵਾਂਗੀ ਅਤੇ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਅੱਗੇ ਦੇ ਵਾਸਤੇ ਟ੍ਰੇਨਡ ਕਰਵਾਂਵਗੀ